ਗੋਡਿਆਂ ਦਾ ਦਰਦ ਆ ਜਿਹੜਾ ਇਹਨੂੰ ਠੀਕ ਕਰਨ ਲਈ ਸਾਡੇ ਪਿੰਡ ਵਿੱਚ ਜਿਸ ਤਰ੍ਹਾਂ ਜਿੰਮ ਵੀ ਹੈਗਾ ਐਕਸਰਸਾਈਜ ਵਾਲੀਆਂ ਮਸ਼ੀਨਾਂ ਨੇ ਉਹਦੇ ਵਿੱਚ ਕਈ ਤਰ੍ਹਾਂ ਦੇ ਤੇਲ ਵੀ ਬੀਬੀਆਂ ਬਣਾ ਕੇ ਵੇਚਦੀਆਂ ਨੇ ਜਿਸ ਤਰ੍ਹਾਂ ਤਿਲਾਂ ਦਾ ਤੇਲ ਅਲਸੀ ਦਾ ਮਤਲਬ ਪਿੰਨੀਆਂ ਵਗੈਰਾ ਬਣਾ ਕੇ ਵੇਚਦੀਆਂ ਨੇ ਵੀ ਉਹ ਖਾਣ ਨਾਲ ਵੀ ਗੋਡਿਆਂ ਦਾ ਦਰਦ ਠੀਕ ਹੁੰਦਾ ਆਪਣੇ ਤਿਲਾਂ ਦਾ ਤੇਲ ਬਾਕੀ ਹੋਰ ਵੀ ਕਈ ਤਰ੍ਹਾਂ ਦੇ ਪ੍ਰੋਡਕਟ ਨੇ ਜਿਹੜੇ ਸਾਡੇ ਪਿੰਡ ਵਿੱਚ ਗੋਡਿਆਂ ਦੇ ਦਰਦ ਲਈ ਮੌਜੂਦ ਹਨ ਬੀਬੀਆਂ ਨਾਲੇ ਆਪਣਾ ਕਾਰੋਬਾਰ ਚਲਾਉਂਦੀਆਂ ਨੇ ਨਾਲੇ ਲੋਕਾਂ ਦੇ ਮਤਲਬ ਇਸ ਤਰ੍ਹਾਂ ਦੇ ਰੋਗ ਠੀਕ ਹੁੰਦੇ ਹਨ ਉਹਦੇ ਨਾਲ